ਸਤਿ ਸ਼੍ਰੀ ਅਕਾਲ ਸਰ ਕੀ ਤੁਸੀਂ ਸਟੇਸ਼ਨ ਫੋਟੀ ਸੈਵਨ ਕੈਫੇ ਤੋਂ ਬੋਲ ਰਹੇ ਹੋ ਮੇਰਾ ਨਾਮ ਸਨੇਹਾ ਕੁਮਾਰੀ ਹੈ ਅਤੇ ਮੈਂ ਨੀਅਰ ਗੁਰਦੁਆਰਾ ਲਕੀਰ ਸਾਹਿਬ ਦੀਪ ਐਵਨਿਊ ਦੇ ਲਾਗੇ ਰਹਿੰਦੀ ਹਾਂ ਮੈਂ ਤੁਹਾਡੇ ਕੈਫੇ ਦਾ ਨਾਮ ਬਹੁਤ ਜ਼ਿਆਦਾ ਸੁਣਿਆ ਹੈ ਇਸ ਕਰਕੇ ਮੈਂ ਤੁਹਾਡੇ ਕੈਫੇ ਤੋਂ ਕੁਛ ਸਮਾਨ ਔਡਰ ਕਰਨਾ ਚਾਹੁੰਦੀ ਹਾਂ ਰਾਤ ਨੂੰ ਮੇਰੇ ਕੁਛ ਰੈਲੇਟਿਵਸ ਅਤੇ ਮੇਰੇ ਫਰੈਂਡਸ ਘਰ ਨੇ ਉਹਨਾਂ ਨੇ ਘਰ ਆਉਣਾ ਹੈ ਤਾਂ ਇਸ ਕਰਕੇ ਮੈਂ ਤੁਹਾਡੇ ਕੈਫੇ ਤੋਂ ਮਤਲਵ ਕੁਛ ਔਡਰ ਕਰਨਾ ਚਾਹੁੰਦੀ ਹਾਂ ਇਸ ਕਰਕੇ ਮੈਨੂੰ ਤੁਸੀਂ ਸਾਰਾ ਦੱਸ ਦਿਉ ਕੀ ਤੁਹਾਡਾ ਰਾਤ ਤੱਕ ਓਪਨ ਹੁੰਦਾ ਹੈ ਕੈਫੇ ਕਿਉਂਕਿ ਮੈਂ ਰਾਤ ਨੂੰ ਹੀ ਡਿਲੀ ਮਤਲਵ ਕਰਨਾ ਹੈ ਮਤਲਬ ਔਡਰ ਅਤੇ ਤੁਸੀਂ ਕੁਛ ਬਰਗਰ ਮਤਲਬ ਚਾਰ ਬਰਗਰ ਚਾਰ ਕੋਲਡ ਡਰਿੰਕਸ ਅਤੇ ਕੁਛ ਦਾਲ ਮੱਖਣੀ ਪਨੀਰ ਅਤੇ ਕੁਛ ਨਾਨ ਲਿਖ ਲਿਓ ਅਤੇ ਮੈਨੂੰ ਮੈਂ ਕੈਸ਼ ਔਨ ਡਿਲੀਵਰੀ ਕਰਾਂਗੀ ਜਦੋਂ ਡਿਲੀਵਰੀ ਬੋਆਏ ਮੇਰੇ ਉੱਥੇ ਘਰ ਦੇ ਨੇੜੇ ਆ ਜਾਵੇਗਾ ਤੁਸੀਂ ਕਿਰਪਾ ਕਰਕੇ ਮੈਨੂੰ ਕੋਲ ਕਰ ਦਿਓ ਮੈਂ ਕੋਲ ਪਿੱਕ ਕਰ ਲਵਾਂਗੀ ਅਤੇ ਆਪਣਾ ਔਡਰ ਰਿਸੀਵ ਕਰ ਲਊਂਗੀ ਫਿਰ ਤੁਸੀਂ ਮੈਨੂੰ ਮੈਂ ਕੈਸ਼ ਔਨ ਡਿਲੀਵਰੀ ਕਰੂੰਗੀ ਉੱਥੇ ਹੀ ਮੈਂ ਉਹਨੂੰ ਆਪਣੀ ਪੇਮੈਂਟ ਕਰ ਦੂੰਗੀ ਅਤੇ ਤੁਸੀਂ ਇਹ ਧਿਆਨ 'ਚ ਰੱਖਿਓ ਕਿ ਜਿਹੜਾ ਖਾਣਾ ਵਾ ਉਹ ਪੂਰਾ ਗਰਮ ਹੋਵੇ ਅਤੇ ਸਹੀ ਹੋਵੇ ਕਿਉਂਕਿ ਮੈਂ ਮੇਰੇ ਰੈਲੇਟਿਵਸ ਨੇ ਬਹੁਤ ਜ਼ਿਆਦਾ ਇੱਥੋਂ ਦਾ ਨਾਮ ਸੁਣਿਆ ਹੈ ਇਸ ਕਰਕੇ ਮੈਂ ਉੱਥੇ ਤੁਹਾਡਾ ਔਡਰ ਕਰ ਰਹੀ ਹਾਂ ਮੈਂ ਇਸ ਕਰਕੇ ਤੁਸੀਂ ਮੇਰਾ ਔਡਰ ਲਿਖ ਲਿਓ ਅਤੇ ਸਾਰਾ ਖਾਣਾ ਵਧੀਆ ਹੋਵੇ ਕਿਰਪਾ ਥੈਂਕ ਯੂ ਸੋ ਮੱਚ ਮੈਂ ਫਿਰ ਆਵਾਂਗੀ